ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਹੈ ਮੈਂ ਫੋਟੋ ਬਹੁਤ ਸੋਹਣੀ ਕਰਦਾ ਹਾਂ ਮੈਂ ਫੋਟੋ ਮੋਬਾਇਲ ਫੋਨ ਜਾਂ ਕੈਮਰੇ ਰਾਹੀਂ ਖਿੱਚਦਾ ਹਾਂ ਮੇਰੇ ਘਰਦਿਆਂ ਨੂੰ ਮੇਰੇ ਉੱਤੇ ਮਾਣ ਹੈ ਕਿ ਸਾਡਾ ਮੁੰਡਾ ਜਾਂ ਕੁੜੀ ਆਪਣਾ ਕੰਮ ਆਪ ਕਰ ਰਹੇ ਹਨ ਮੈਂ ਫੋਟੋਗ੍ਰਾਫੀ ਲਈ ਬੜੇ ਦੂਰ ਦੂਰ ਦੇ ਪਿੰਡਾਂ ਵਿੱਚ ਫੋਟੋਗ੍ਰਾਫੀ ਕਰਦਾ ਹਾਂ ਜਾਂ ਵੀਡੀਓ ਬਣਾਉਂਦਾ ਹਾਂ ਮੈਨੂੰ ਦੂਰੋਂ ਦੂਰੋਂ ਆਰਡਰ ਬੁਕਿੰਗ ਕੀਤੇ ਜਾਂਦੇ ਹਨ ਆਮ ਤੌਰ 'ਤੇ ਲੋਕ ਵਿਆਹ ਸ਼ਾਦੀਆਂ ਵਿੱਚ ਫੋਟੋ ਖਿਚਵਾਉਂਦੇ ਹਨ ਫੋਟੋ ਦੀ ਫੋਟੋਸ਼ੂਟ ਦੀ ਮੁਵ ਫੋਟੋਸ਼ੂਟ ਲਈ ਵੀ ਮੈਨੂੰ ਬੂਕ ਕੀਤਾ ਜਾਂਦਾ ਹੈ